ਡਰਾਈਵਿੰਗ ਲਾਇਸੰਸ ਹਰ ਰੋਜ਼ ਦੇ ਆਉਣ ਜਾਣ ਲਈ ਬਹੁਤ ਹੀ ਅਹਿਮ ਹੈ ਇਸ ਨਾਲ ਸਾਡੇ ਕੰਮ ਵਿੱਚ ਵੀ ਬਹੁਤ ਤਬਦੀਲੀਆਂ ਆਉਂਦੀਆਂ ਹਨ ਅਤੇ ਸਾਡੇ ਕੰਮ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ਜੇਕਰ ਇਹ ਡਰਾਈਵਿੰਗ ਲਾਇਸੰਸ ਨਾ ਉਪਲਬਧ ਹੋਵੇ ਤਾਂ ਸਾਨੂੰ ਹੋਰ ਵੀ ਤਕਲੀਫਾਂ ਝੱਲਣੀਆਂ ਪੈ ਸਕਦੀਆਂ ਹਨ ਇਸ ਨਾਲ ਕੋਈ ਪੁਲਿਸ ਅਫਸਰ ਰੋਕ ਲਵੇ ਤਾਂ ਉਹ ਸਾਡੀਆਂ ਗੱਲਾਂ ਉੱਤੇ ਯਕੀਨ ਨਹੀਂ ਕਰਦਾ ਅਤੇ ਸਾਨੂੰ ਫਾਈਨ ਪਾ ਦਿੰਦਾ ਹੈ ਜਿਹੜਾ ਕਿ ਸਾਨੂੰ ਬਹੁਤ ਦੇਣਾ ਔਖਾ ਹੁੰਦਾ ਹੈ ਇਸ ਲਈ ਅਜੇ ਮੇਰਾ ਡਰਾਈਵਿੰਗ ਲਾਇਸੰਸ ਨਹੀਂ ਆਇਆ ਇਸ ਕਰਕੇ ਜਲਦੀ ਤੋਂ ਜਲਦੀ ਇਸ ਦੀ ਕੋਈ ਅਪਡੇਟ ਮੈਨੂੰ ਦਿੱਤੀ ਜਾਵੇ ਅਤੇ ਮੈਂ ਆਪਣਾ ਲਾਇਸੰਸ ਬਣਵਾ ਸਕਾਂ